ਸਥਾਨਿਕ ਆਰਥਿਕਤਾ ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ ਹਰ ਕਿਸੇ ਬੰਦੇ ਨੂੰ ਆਪਣੀ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਇਨਕਮ ਦੀ ਜ਼ਰੂਰਤ ਹੁੰਦੀ ਹੈ ਜੋ ਆਪਾਂ ਨੂੰ ਡੇਲੀ ਰੂਟੀਨ ਦੇ ਕੰਮ ਕਰਕੇ ਜਿਸ ਤੋਂ ਆਪਣੀ ਕਮਾਈ ਕਰਕੇ ਉਹ ਆਪਣੇ ਘਰ ਦੇ ਖ਼ਰਚੇ ਪੂਰੇ ਕਰਦੇ ਹਨ ਅਤੇ ਆਪਣੇ ਸੇਵਿੰਗਸ ਕਰਦੇ ਹਨ ਛੋਟੇ ਛੋਟੇ ਕਾਰੋਬਾਰ ਦੇ ਵਿੱਚ ਹਰ ਤਰ੍ਹਾਂ ਦਾ ਮਾੜਾ ਵਿਅਕਤੀ ਕੰਮ ਕਰਦਾ ਹੈ ਅਤੇ ਉਸ ਤੋਂ ਆਪਣਾ ਲਾਭ ਕਮਾਉਂਦਾ ਹੈ ਇਹ ਹੀ ਛੋਟੇ ਛੋਟੇ ਜਿਹੜੇ ਕਾਰੋਬਾਰ ਹਨ ਇਹ ਵੱਡੇ ਕਾਰੋਬਾਰਾਂ 'ਤੇ ਡਿਪੈਂਡ ਹੁੰਦੇ ਹਨ ਜਿਸ ਤਰ੍ਹਾਂ ਸਪੋਜ ਕਰੋ ਕੋਈ ਵੀ ਸਮਾਨ ਵੱਡੀਆਂ ਮੰਡੀਆਂ ਤੋਂ ਛੋਟੇ ਸ਼ਹਿਰਾਂ ਦੀਆਂ ਮੰਡੀਆਂ ਤੱਕ ਆਉਂਦਾ ਹੈ ਉਸ ਤੋਂ ਬਾਅਦ ਲੋਕਲ ਵਪਾਰਿਕ ਦੁਕਾਨਦਾਰ ਮੰਡੀਆਂ ਤੋਂ ਲੈ ਕੇ ਉਹਨੂੰ ਆਪਣੀ ਦੁਕਾਨਾਂ ਤੱਕ ਵੇਚਣ ਜਾਂਦੇ ਹਨ ਪਹਿਲਾਂ ਤਾਂ ਵੱਡੀਆਂ ਮੰਡੀਆਂ ਦੇ ਰੂਪ ਵਿੱਚ ਕਾਫ਼ੀ ਜ਼ਿਆਦਾ ਕੰਮ ਨਿਕਲਦਾ ਹੈ ਜਿਸ ਵਿੱਚ ਲੇਬਰ ਵੀ ਕੰਮ ਕਰਦੀ ਹੈ ਜਾਂ ਵੱਡੇ ਬਿਜਨਸਮੈਨ ਕੰਮ ਕਰਦੇ ਹਨ ਉੱਥੋਂ ਪਰਚੇਸ ਕਰਕੇ ਇਹ ਛੋਟੀਆਂ ਦੁਕਾਨਾਂ ਤੱਕ ਸਮਾਨ ਪਹੁੰਚਾਇਆ ਜਾਂਦਾ ਹੈ ਛੋਟੇ ਦੁਕਾਨਦਾਰ ਰਿਟੇਲ ਗਾਹਕਾਂ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਸਮਾਨ ਵੇਚ ਕੇ ਥੋੜ੍ਹਾ ਥੋੜ੍ਹਾ ਪਰੋਫਿਟ ਕਮਾ ਕੇ ਆਪਣਾ ਗੁਜ਼ਾਰਾ ਕਰਦੇ ਹਨ ਇਹ ਲੋਕਾਂ ਦੀਆਂ ਸਹੂਲਤਾਂ ਦੇ ਵਿੱਚ